ਸਤਿ ਸ਼੍ਰੀ ਅਕਾਲ ਸਰ ਮੈਨੂੰ ਉਮੀਦ ਹੈ ਤੁਸੀਂ ਬਹੁਤ ਵਧੀਆ ਹੋਵੋਗੇ ਅਸੀਂ ਕੱਲ੍ਹ ਆਪਣੇ ਪੂਰੇ ਪਰਿਵਾਰ ਸਮੇਤ ਬਠਿੰਡਾ ਵਿੱਚ ਵਿੱਚ ਪਾਰਕ ਵਿੱਚ ਅਸੀ ਸੈਰ ਸਪਾਟੇ ਲਈ ਟਿਕਟਾਂ ਬੁ ਬੁੱਕ ਕੀਤੀਆਂ ਸਨ ਪ੍ਰੰਤੂ ਕੱਲ੍ਹ ਮੌਸਮ ਵਧੀਆ ਸੀ ਅਤੇ ਅੱਜ ਮੌਸਮ ਖਰਾਬ ਹੋ ਗਿਆ ਅਸੀਂ ਆਉਣ ਦੀ ਤਿਆਰੀ ਵਿੱਚ ਸਨ ਜਦੋਂ ਅਸੀਂ ਰਸਤੇ ਵਿੱਚ ਪਹੁੰਚੇ ਤਾਂ ਮੌਸਮ ਖਰਾਬ ਦੇ ਕਾਰਨ ਸਾਡੀ ਖਰ ਕਾਰ ਖਰਾਬ ਹੋ ਗਈ ਜਿਸ ਦੇ ਅਨੁਸਾਰ ਅਸੀਂ ਪਾਰਕ ਵਿੱਚ ਸਹੀ ਸਮੇਂ 'ਤੇ ਪਹੁੰਚ ਨਹੀਂ ਸਕਦੇ ਇਸ ਲਈ ਸਾਡੇ ਦੁਆਰਾ ਜੋ ਖਰਚ ਕਰਕੇ ਲਈਆਂ ਗਈਆਂ ਟਿਕਟਾਂ ਦੀ ਵਾਪਸੀ ਕੀਤੀ ਜਾਵੇ ਅਤੇ ਸਾਡੇ ਬਣਦੇ ਪੈਸੇ ਸਾਨੂੰ ਵਾਪਸ ਦਿੱਤੇ ਜਾਣ ਅਗਰ ਤੁਸੀਂ ਆਪਣਾ ਵਿੱਚੋਂ ਕੁਝ ਹਿੱਸਾ ਰੱਖਣਾ ਚਾਹੁੰਦੇ ਹਾਂ ਤਾਂ ਉਹ ਵੀ ਰੱਖ ਸਕਦੇ ਹੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰੰਤੂ ਸਾਨੂੰ ਅੱਧੇ ਪੈਸੇ ਜ਼ਰੂਰ ਮੋੜੋ ਜੀ ਇਸ ਲਈ ਸਾਡੇ ਦੁਆਰਾ ਜੋ ਬੁੱਕ ਕੀਤੀਆਂ ਹੋਈਆਂ ਟਿਕਟਾਂ ਦੇ ਪੈਸੇ ਸਾਨੂੰ ਸਹੀ ਸਮੇਂ 'ਤੇ ਦਿੱਤੇ ਜਾਣ ਅਸੀਂ ਜਦੋਂ ਅਸੀਂ ਜਦੋਂ ਦੁਦਾ ਕੋਲ ਪਹੁੰਚੇ ਤਾਂ ਉੱਥੇ ਮੌਸਮ ਇਕਦਮ ਖਰਾਬ ਹੋ ਗਿਆ ਜਿਸ ਦੇ ਕਾਰਨ ਸਾਡੀ ਕਾਰ ਦੇ ਇੰਜਣ ਵਿੱਚ ਪਾਣੀ ਪੈ ਗਿਆ ਅਤੇ ਕਾਰ ਖਰਾਬ ਹੋ ਗਈ ਜਿਸ ਦੇ ਕਾਰਨ ਸਾਡਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਾਰ ਦਾ ਸਾਡੀ ਇਸ ਟਿਕਟ ਵਾਪਸ ਸਾਡੀਆਂ ਜੋ ਦਿੱਤੀਆਂ ਹੋਈਆਂ ਟਿਕਟਾਂ ਨੂੰ ਵਾਪਸ ਕੀਤਾ ਜਾਵੇ ਅਤੇ ਸਾਡੀ ਸਹੀ ਸਾਡੇ ਦੁਆਰਾ ਦਿੱਤੇ ਗਏ ਪੈਸੇ ਸਾਨੂੰ ਵਾਪਸ ਕੀਤੇ ਜਾਣ ਮੌਸਮ ਦਾ ਪਤਾ ਨਹੀਂ ਲੱਗਦਾ ਕਦੋਂ ਖਰਾਬ ਹੋ ਜਾਂਦਾ ਹੈ ਇਸ ਵਿੱਚ ਸਾਡੀ ਕੋਈ ਗਲਤੀ ਨਹੀਂ ਹੈ ਗਲਤੀ ਸਾਰੀ ਮੌਸਮ ਦੀ ਹੈ ਸੋ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਦੁਆਰਾ ਬੁੱਕ ਕੀਤੀਆਂ ਹੋਈਆਂ ਟਿਕਟਾਂ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਸਹੀ ਸਮੇਂ 'ਚ ਕੀਤੇ ਜਾਣ ਸਾਡੇ ਦੁਆਰਾ ਬਣਾਇਆ ਗਿਆ ਪ੍ਰੋਗਰਾਮ ਸਾਰਾ ਖਰਾਬ ਹੋ ਗਿਆ ਅਸੀਂ ਬੜੇ ਰੀਝਾਂ ਨਾਲ ਇਹ ਪ੍ਰੋਗਰਾਮ ਰੱਖਿਆ ਸੀ ਪਾਰਕ ਘੁੰਮਣ ਦਾ ਬੱਚੇ ਵੀ ਬਹੁਤ ਪ੍ਰਸੰਨ ਸਨ ਕਿ ਅਸੀਂ ਪਾਰਕ ਵਿੱਚ ਜਾਣਾ ਹੈ ਪ੍ਰੰਤੂ ਮੌਸਮ ਦੀ ਅਜਿਹੀ ਮਾਰ ਪਈ ਕਿ ਸਾਰਾ ਪਲੈਨ ਖਤਮ ਕਰ ਦਿੱਤਾ ਅਤੇ ਸਾਡੀਆਂ ਆਸਾਂ 'ਤੇ ਪਾਣੀ ਫਿਰ ਗਿਆ ਇਸ ਲਈ ਸਰ ਮੌਸਮ ਦੀ ਵਜ੍ਹਾ ਨਾਲ ਇਹ ਸਭ ਕੁਝ ਹੋਇਆ ਹੈ ਤਾਂ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਵਾਪਸ ਪੈਸੇ ਵਾਪਸ ਕੀਤੇ ਜਾਣ